ਅਸੀਂ ਸਕੂਲ ਦਾ ਪ੍ਰੋਜੈਕਟ ਬਣਾਉਣ ਲਈ ਘਰੋਂ ਹੀ ਤਿਆਰੀ ਕਰ ਲੈਂਦੇ ਸੀ ਸਾਰੇ ਦੋਸਤ ਮਿੱਤਰ ਮਿਲ ਕੇ ਕੋਈ ਡੱਕੇ ਲਿਆਉਂਦਾ ਸੀ ਕੋਈ ਅੰਡਿਆਂ ਵਾਲੀਆਂ ਖਾਲੀ ਟ੍ਰੇਆਂ ਹੁੰਦੀਆਂ ਸੀ ਉਹ ਕੋਈ ਸ਼ਨੀਲ ਅਤੇ ਕੋਈ ਤਾਰ ਲਿਆਦਾ ਏ ਘਰੋਂ ਹੀ ਅਸੀਂ ਸਾਰੀ ਤਿਆਰੀ ਕਰਕੇ ਆਪਣਾ ਪਰਾਲੀ ਹੁੰਦੀ ਤਾਂ ਅਸੀਂ ਵਧੀਆ ਜਿਹਾ ਪ੍ਰੋਜੈਕਟ ਘਰੋਂ ਹੀ ਤਿਆਰ ਕਰ ਲੈਂਦੇ ਫਿਰ ਅਸੀਂ ਉਸ ਨੂੰ ਸਕੂਲ ਵਿੱਚ ਲੈ ਕੇ ਜਾਂਦੇ ਅਸੀਂ ਕੋਈ ਪੈਸਾ ਵੀ ਨਹੀਂ ਯੂਜ ਕਰਦੇ ਸੀ ਅਸੀਂ ਬਹੁਤ ਬਹੁਤ ਵਧੀਆ ਪ੍ਰੋਜੈਕਟ ਤਿਆਰ ਕਰਦੇ ਸੀ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਦੀ ਫੋਟੋ ਬਣਾਉਣੀ ਤਾਂ ਇੱਕ ਉਹ ਆਂਡਿਆਂ ਵਾਲੀ ਹੁੰਦੀ ਹੈ ਟ੍ਰੇ ਉਸ ਦੇ ਪਿੱਛੇ ਕੱਪੜਾ ਲਾ ਕੇ ਉਸ ਦੇ ਉੱਤੇ ਸ਼ੀਸ਼ੇ ਲਾਉਣੇ ਨਾਲ ਉਹਦੇ ਗਾਨੀਆਂ ਜਿਹੀਆਂ ਲਟਕਾ ਦੇਣੀਆਂ ਸੋਹਣੀ ਜਿਹੀ ਉਹ ਬਣ ਜਾਣੀ ਸੀਨਰੀ ਬਹੁਤ ਵਧੀਆ ਸੀਨਰੀ ਬਣ ਜਾਂਦੀ ਸੀ ਜੋ ਅਸੀਂ ਤਿਆਰ ਕਰ ਲੈਂਦੇ ਸੀ